ਲੋਕ ਵਿਆਹ 'ਤੇ ਲਾੜੀ ਨੂੰ ਬਹੁਤ ਸਾਰੇ ਤੋਹਫੇ ਦਿੰਦੇ ਹਨ ਜਿਵੇਂ ਰਿਸ਼ਤੇਦਾਰ ਆਉਂਦੇ ਹੈ ਸਾਰੇ ਸੂਟ ਲਿਆਉਂਦੇ ਹੈ ਲਾੜੀ ਦਾ ਮੇਕਅੱਪ ਦਾ ਸਮਾਨ ਉਹਦਾ ਤਿਆਰ ਹੋਣ ਦਾ ਸਮਾਨ ਲਿਆਉਂਦੇ ਹੈ ਜੁੱਤੀਆਂ ਹੁੰਦੀਆਂ ਹੈ ਉਸਦੇ ਬਿਸਤਰੇ ਹੁੰਦੇ ਹੈ ਚੱਦਰਾਂ ਹੁੰਦੀਆ ਸ਼ੌਲਾਂ ਹੁੰਦੀਆਂ ਹੈ ਕਢਾਈ ਕੀਤੀ ਹੋਈ ਹੋਰ ਕੱਪੜੇ ਚੁੰਨੀਆਂ ਹੁੰਦੀਆਂ ਹੈ ਬੜੇ ਸੋਹਣੇ ਸੋਹਣੇ ਡਿਜ਼ਾਈਨ ਬਣਾ ਕੇ ਲਿਆਉਂਦੇ ਹੈ ਅਤੇ ਹੋਰ ਤਾਂ ਹੋਰ ਉਹਦੀ ਦਰੀਆਂ ਵੀ ਬੁਣ ਕੇ ਲਿਆਉਂਦੇ ਹੈ ਵਧੀਆ ਵਧੀਆ ਡਿਜ਼ਾਈਨ ਪਾ ਕੇ ਅਤੇ ਦਾਜ ਦੇ ਵਿੱਚ ਵੀ ਇਹੀ ਸਾਰਾ ਸਮਾਨ ਰੱਖਿਆ ਜਾਂਦਾ ਹੈ ਘਰ ਦਾ ਫ਼ਰਨੀਚਰ ਹੋਊਗਾ ਸੌਫੇ ਕੁਰਸੀਆਂ ਫਰਿੱਜ ਟੀ ਵੀ ਅਤੇ ਇਹ ਸਾਰਾ ਸਮਾਨ ਹੋਏਗਾ ਰਸੋਈ ਦਾ ਸਮਾਨ ਹੁੰਦਾ ਭਾਂਡੇ ਹੁੰਦੇ ਹੈ ਉਸ 'ਚ ਭਾਂਡਿਆਂ 'ਚ ਸਟੀਲ ਦੇ ਭਾਂਡੇ ਵੀ ਰੱਖਣਗੇ ਅਤੇ ਅੱਜ ਕੱਲ੍ਹ ਜਿਹੜੀ ਕਰੋਕਰੀ ਚੱਲਦੀ ਉਹ ਵਾਲੇ ਭਾਂਡੇ ਵੀ ਰੱਖਦੇ ਹੈ ਕਿਵੇਂ ਫੇਰ ਸਭ ਦਾ ਸ਼ਗਨ ਵੀ ਰੱਖਦੇ ਹੈ ਉਹ ਦਾਜ ਦੇ ਵਿੱਚ ਹੋਰ ਤਾਂ ਹੋਰ ਅੱਜ ਕੱਲ੍ਹ ਅੰਗੂਠੀਆਂ ਜੇਵਰ ਦੇਣ ਦਾ ਵੀ ਬਹੁਤ ਰਿਵਾਜ਼ ਹੈ ਵਿਆਹ 'ਚ ਲਾੜੀ ਨੂੰ ਤਾਂ ਆਪਾ ਦੇਣਾ ਹੀ ਦੇਣਾ ਜਿਹੜਾ ਦਿੰਦੇ ਹੈ ਉਹ ਸੋਨਾ ਅਤੇ ਨਾਲ ਉਹਦੇ ਰਿਸ਼ਤੇਦਾਰਾਂ ਨੂੰ ਉਹਦੇ ਸੱਸ ਨੂੰ ਸੋਹਰੇ ਨੂੰ ਦਰਾਣੀ ਨੂੰ ਜੇਠ ਨੂੰ ਅਤੇ ਨਾਲ ਉਹਦੀ ਭੈਣਾਂ ਨਣਾਨਾਂ ਨੂੰ ਨਣਦੋਈਆਂ ਤੱਕ ਨੂੰ ਵੀ ਦਾਜ ਦਿੱਤਾ ਜਾਂਦਾ ਹੈ ਅਤੇ ਆਹ ਸਾਰਾ ਸਮਾਨ ਦੇ ਕੇ ਲਾੜੀ ਨੂੰ ਵਿਦਾ ਕਰਦੇ ਹੈ ਉਹ ਸੋਚਦੇ ਹੈ ਕਿ ਸਾਡੀ ਲਾੜੀ ਵਧੀਆ ਤਰੀਕੇ ਨਾਲ ਰਹੇਗੀ ਘਰ 'ਚ ਖੁਸ਼ੀ ਰਹੇਗੀ ਉਹ ਜਿੰਨਾ ਕਹਿੰਦੇ ਅਸੀਂ ਉਹਨੂੰ ਦਾਜ ਦਉਗੇ ਉਨ੍ਹਾਂ ਨੂੰ ਓਨਾ ਮਾਨ ਸਨਮਾਨ ਮਿਲੇਗਾ ਅਤੇ ਦਾਜ ਤਾਂ ਫਿਰ ਇਹੀ ਸਾਰਾ ਸਮਾਨ ਹੋ ਗਿਆ ਨਾ ਲਾੜੀ ਵਾਸਤੇ ਕੱਪੜੇ ਭਾਂਡੇ ਬਿਸਤਰੇ ਫ਼ਰਨੀਚਰ ਅਤੇ ਅੱਜ ਕੱਲ੍ਹ ਦਾ ਹੋਰ ਏ ਸੀ ਅਤੇ ਮਾਈਕਰੋਵੇਵ ਚੱਲਦੇ ਹੈ